ਹਾਂਜੀ ਜਿਹੜਾ ਪੇਂਡੂ ਖੇਤਰਾਂ ਦੇ ਵਿੱਚ ਹੈਗਾ ਸ਼ਹਿਰੀ ਖੇਤਰਾਂ ਦੇ ਨਾਲੋਂ ਜਿਹੜਾ ਸਾਧਨਾ ਦੀ ਘਾਟ ਉਹ ਤਾਂ ਹੈਗੀ ਆ ਆਪਾਂ ਸਾਰਿਆਂ ਨੂੰ ਹੀ ਪਤਾ ਹੈਗਾ ਕਿਉਂਕਿ ਸ਼ਹਿਰਾਂ ਦਾ ਜ਼ਿਆਦਾ ਵਿਕਾਸ ਹੋਇਆ ਹੁੰਦਾ ਪਿੰਡਾਂ ਦਾ ਘੱਟ ਹੋ ਹੁੰਦਾ ਜਿਹੜੇ ਪਿੰਡ ਸ਼ਹਿਰਾਂ ਦੇ ਬਿਲਕੁਲ ਲਾਗੇ ਹੁੰਦੇ ਚਲੋ ਉਹਨਾਂ ਨੂੰ ਕੋਈ ਬਾਹਲਾ ਫਰਕ ਨਹੀਂ ਪੈਂਦਾ ਉਹ ਈਜ਼ੀਲੀ ਜਿਹੜੀ ਆਪਦੀ ਪਹੁੰਚ ਸ਼ਹਿਰ ਕਰ ਸਕਦੇ ਹਾਂ ਪਰ ਕਈ ਪਿੰਡ ਅਜਿਹੇ ਨੇ ਜਿਹੜੇ ਸ਼ਹਿਰਾਂ ਤੋਂ ਬਹੁਤ ਜ਼ਿਆਦਾ ਦੂਰ ਨੇ ਉੱਥੇ ਇੰਨੀਆਂ ਨਾ ਤਾਂ ਸਿਹਤ ਸਹੂਲਤਾਂ ਹੁੰਦੀਆਂ ਹੈਗੀਆਂ ਅਤੇ ਜਿਹੜਾ ਕਿ ਅਪਰਾਧ ਵੀ ਉੱਥੇ ਵੱਧਦਾ ਨਸ਼ੇ ਪੱਤੇ ਦਾ ਵੀ ਇੰਨੇ ਲੋਕ ਜਾਗਰੂਕ ਨਹੀਂ ਹੁੰਦੇ ਇਸ ਹੈ ਹੈਗਾ ਪ੍ਰਭਾਵ ਪੈਂਦਾ ਹੈਗਾ ਇਸ ਲਈ ਸਰਕਾਰ ਨੂੰ ਚਾਹੀਦਾ ਹੈਗਾ ਵੀ ਜਿਹੜਾ ਇਹਨਾਂ ਨੂੰ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਇਹ ਕੋਈ ਇੱਦਾਂ ਦੇ ਪ੍ਰੋਗਰਾਮ ਉਲੀਕੇ ਜਾਂ ਉੱਥੋਂ ਉਹਨਾਂ ਪਿੰਡਾਂ ਦੇ ਵਿੱਚ ਵੀ ਸਿਹਤ ਸਹੂਲਤਾਂ ਅਤੇ ਜੇ ਹੈਗੀਆੰ ਛੋਟੀਆਂ ਛੋਟੀਆਂ ਡਿਸਪੈਂਸਰੀ ਜਿਹੀਆਂ ਬਣੀਆਂ ਹੋਈਆਂ ਉਹ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਵੀ ਭਾਈ ਜਿਹੜਾ ਤੁਹਾਡਾ ਨਸ਼ਾ ਵਗੈਰਾ ਨਾ ਵੈਸੇ ਤਾਂ ਚੱਲ ਰਿਹਾ ਸਾਰੇ ਸਮਝਾਈ ਰਹੇ ਨੇ ਇੱਦਾਂ ਦੀ ਕੋਈ ਗੱਲ ਨਹੀਂ ਵੀ ਅਤੇ ਸਾਰੇ ਜਾਗਰੂਕ ਹੈਗੇ ਆ ਭਾਵੇਂ ਪਿੰਡ ਆ ਭਾਵੇਂ ਸ਼ਹਿਰ ਦੇ ਸਾਰੇ ਲੋਕ ਜਾਗਰੂਕ ਆ ਕਿ ਵੀ ਨਸ਼ਾ ਸਿਹਤ ਲਈ ਮਾਨੀ ਹਾਨੀਕਾਰਕ ਹੈਗਾ ਅਪਰਾਧ ਚਲੋ ਹੁੰਦੇ ਹੈਗੇ ਪਤਾ ਨਹੀਂ ਕੁਛ ਕੁ ਲੋਕ ਕਰਦੇ ਨੇ ਉਹ ਕਰੀ ਵੀ ਜਾਂਦੇ ਨੇ ਪਰ ਉਹ ਕਦੇ ਤਾਂ ਪਕੜ ਦੇ ਵਿੱਚ ਆਉਣਗੇ ਸਰਕਾਰ ਵੀ ਵੈਸੇ ਤਾਂ ਬਹੁਤ ਜ਼ਿਆਦਾ ਯੋਗਦਾਨ ਆਪਣਾ ਅਦਾ ਕਰ ਰਹੀ ਹੈ ਨਸ਼ੇ ਨੂੰ ਘਟਾਉਣ ਦੇ ਵਿੱਚ ਅਪਰਾਧ ਨੂੰ ਘਟਾਉਣ ਦੇ ਵਿੱਚ ਹੌਲੀ ਹੌਲੀ ਫਰਕ ਪੈ ਹੀ ਜਾਵੇਗਾ